ਹਾਂਜੀ ਪੰਜਾਬੀ ਇੱਕ ਸਾਡੀ ਮਾਂ ਬੋਲੀ ਹੈ ਪੰਜਾਬ ਦੇ ਵਿੱਚ ਅਸੀਂ ਹਰ ਜਦੋਂ ਅਸੀਂ ਪੜ੍ਹਦੇ ਸੀਗੇ ਹਰ ਕਿਤਾਬ ਜੋ ਵੀ ਅਸੀਂ ਪੜ੍ਹਦੇ ਸੀ ਪੰਜਾਬੀ ਵਿੱਚ ਪੜ੍ਹਦੇ ਸੀਗੇ ਹੋਰ ਵੀ ਜੋ ਕਾਰੋਬਾਰ ਆਪਾਂ ਲਿਖਦੇ ਪੜ੍ਹਦੇ ਸੁਣਦੇ ਸੀ ਪੰਜਾਬੀ ਦੇ ਵਿੱਚ ਲਿਖਦੇ ਸਨ ਪੰਜਾਬੀ ਵਿਚ ਬੋਲਦੇ ਹਨ ਇਹ ਪੰਜਾਬੀ ਸਾਡੀ ਇੱਕ ਮਾਂ ਬੋਲੀ ਹੈ ਇਸਨੂੰ ਅਸੀਂ ਬਹੁਤ ਧੰਨਵਾਦ ਕਰਦੇ ਹਨ ਅੱਗੇ ਵਾਸਤੇ ਪੰਜਾਬੀ ਬੋਲੀ ਸਾਡੇ ਲਈ ਮਹਾਰਾਜ ਕਿਰਪਾ ਕਰੇ